ਮੇਰੇ ਕੋਲ ਸਟੈਂਪ ਸਿੱਕੇ ਬਹੁਤ ਤਰ੍ਹਾਂ ਦੇ ਐਂ ਮੈਂ ਮੈਨੂੰ ਇਕੱਠੇ ਕਰਨ ਦਾ ਬਹੁਤ ਸ਼ੌਕ ਆ ਮੈਨੂੰ ਆਪਣੇ ਦੇਸ਼ ਦਾ ਅਤੇ ਹੋਰ ਤੇ ਦੇ ਦੇਸ਼ਾਂ ਦਾ ਵੀ ਸਿੱਕੇ ਐਂ ਬਹੁਤੇ ਸਾਰੇ ਸਿੱਕੇ ਹੈਗੇ ਮੇਰੇ ਕੋਲ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਇਕੱਠੇ ਕਰਕੇ ਰੱਖਦੀ ਹਾਂ ਉਹਨੂੰ ਸਾਂਭ ਕੇ ਰੱਖਦੀ ਹਾਂ ਅਤੇ ਮੈਨੂੰ ਮਤਲਬ ਬਹੁਤ ਅੱਛ ਵਧੀਆ ਲੱਗਦਾ ਕਿ ਮੈਂ ਇਕੱਠੇ ਕਰਾਂ ਮੈਂ ਹੋਰਾਂ ਨੂੰ ਵੀ ਦਿਖਾਉਂਦੀ ਹਾਂ ਕਿ ਮਤਲਬ ਮੇਰੇ ਕੋਲ ਅ ਇਸ ਤਰ੍ਹਾਂ ਦੇ ਸਿੱਕੇ ਐਂ ਇਸ ਦੇਸ਼ ਦੇ ਸਿੱਕੇ ਐਂ ਮੈਂ ਉਹਨੂੰ ਇਖੱਟਾ ਕਰਦੀ ਹਾਂ ਅਤੇ ਮੈਂ ਉਹਨੂੰ ਅ ਇੱਕ ਡੱਬੇ 'ਚ ਰੱਖੇ ਹੋਏ ਆ ਕਿ ਮਤਲਬ ਕਿਤੇ ਗੁੰਮ ਨਾ ਹੋਵੇ ਅਤੇ ਇਹ ਮਦਦ ਵੀ ਹੁੰਦੀ ਹੈ ਕਿ ਮਤਲਬ ਕਰੰਸੀ ਪਤਾ ਲੱਗਦੀ ਆ ਕਿਹੜੇ ਦੇਸ਼ ਦੀ ਕਿਹੜੀ ਹੈ ਕਿਹੜੇ ਦੇਸ਼ ਦੀ ਕਿਹੜੀ ਐ ਸਾਡੇ ਦੇਸ਼ ਦੀ ਕਿਹੜੀ ਹੈ ਅਤੇ ਨੌਲੇਜ ਵੀ ਵੱਧਦੀ ਇਹਦੇ ਨਾਲ ਅਤੇ ਬੱਚਿਆਂ ਨੂੰ ਦਿਖਾਉਂਦੇ ਹਾਂ ਕਿ ਕਿਹੜੇ ਦੇਸ਼ ਦਾ ਕਿਹੜਾ ਸਿੱਕਾ ਹੈ ਤਾਂ ਫਿਰ ਉਹਨਾਂ ਨੂੰ ਮਤਲਬ ਬਾਅਦ 'ਚ ਜਾਣ 'ਤੇ ਮਤਲਬ ਬਾਹਰ ਜਾਣ 'ਤੇ ਬਹੁਤ ਹੈਲਪ ਹੁੰਦੀ ਹੈ ਕਿ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਕਿਹੜਾ ਕਿ ਕਿਹੜੇ ਦੇਸ਼ ਦਾ ਸਿੱਕਾ ਹੈ ਕਿਹੜਾ ਕਿਹੜੇ ਦੇਸ਼ ਦਾ ਸਿੱਕਾ